ਮੈਂ ਹਿੰਦੁਸਤਾਨ ਦੇ ਕਸ਼ਮੀਰ ਜਿਹਨੂੰ ਸ਼੍ਰੀਨਗਰ ਵੀ ਕਹਿੰਦੇ ਹਨ ਉੱਥੇ ਆਪਣੇ ਪਰਿਵਾਰ ਨਾਲ ਗਿਆ ਸੀ ਅਤੇ ਉੱਥੇ ਡੱਲ ਝੀਲ ਬੀ ਬੀ ਕੈਂਟ ਅਤੇ ਅਮਰਨਾਥ ਯਾਤਰਾ ਉਥੇ ਵੀ ਮੱਥਾ ਟੇਕਿਆ ਅਤੇ ਕਸ਼ਮੀਰ ਵਿੱਚ ਵੀ ਸ਼੍ਰੀਨਗਰ ਵਿੱਚ ਵੀ ਘੁੰਮਿਆ ਜਿੱਥੇ ਮੈਂ ਬੀ ਬੀ ਕੈਂਟ ਜੋ ਮੇਨ ਬਜ਼ਾਰ ਹੈ ਸ਼੍ਰੀਨਗਰ ਦਾ ਅਤੇ ਉੱਥੇ ਵੀ ਘੁੰਮਿਆਂ ਅਤੇ ਉੱਥੋਂ ਦੇ ਜਿਵੇਂ ਕਿ ਸੇਬਾਂ ਦੇ ਦਰੱਖਤ ਅਖਰੋਟਾਂ ਦੇ ਦਰੱਖਤ ਚੈਰੀ ਜਿਹਨੂੰ ਕਹਿੰਦੇ ਹਨ ਉੱਥੇ ਉਹਨਾਂ ਦੇ ਬਾਗਾਂ ਵਿੱਚ ਵੀ ਗਿਆ ਅਤੇ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਗਿਆ ਅਤੇ ਉੱਥੇ ਉਹਨਾਂ ਨੇ ਉਹਨਾਂ ਨੂੰ ਖੁਦ ਆਪਣੇ ਹੱਥੀਂ ਤੋੜਿਆ ਤੋੜ ਕੇ ਜੋ ਉਹਨਾਂ ਨੂੰ ਬੱਚਿਆਂ ਨੂੰ ਆਨੰਦ ਆਇਆ ਅਤੇ ਉੱਥੋਂ ਉਹਨਾਂ ਨੇ ਪੂਰਾ ਆਨੰਦ ਲਿਆ ਉੱਥੋਂ ਬਰਫਬਾਰੀ ਦਾ ਵੀ ਆਨੰਦ ਅਸੀਂ ਲਿੱਤਾ ਅਤੇ ਉੱਥੇ ਡੱਲ ਝੀਲ ਵਿੱਚ ਵੀ ਘੁੰਮੇ ਉਸ 'ਤੇ ਕਿਸ਼ਤੀਆਂ ਬਹੁਤ ਸੋਹਣੀਆਂ ਹਨ ਅਤੇ ਉੱਥੇ ਘੁੰਮ ਕੇ ਅਸੀਂ ਘੱਟੋ ਘੱਟ ਤਿੰਨ ਚਾਰ ਦਿਨ ਉੱਥੇ ਲਗਾਤਾਰ ਰਹੇ ਅਤੇ ਉੱਥੇ ਅਸੀਂ ਵਧੀਆ ਉੱਥੋਂ ਦਾ ਖਾਣ ਪੀਣ ਪਹਿਰਾਵਾ ਸਭ ਕੁਝ ਉੱਥੋਂ ਦਾ ਆਨੰਦ ਲਿੱਤਾ